ਹੈਲੋ ਹਾਂਜੀ ਅੱਛਾ ਅੱਛਾ ਉਹ ਮੈਨੂੰ ਨਾ ਤੁਹਾਡਾ ਨੰਬਰ ਸੁਖਮਨ ਸਰ ਨੇ ਦਿੱਤਾ ਸੀਗਾ ਅਤੇ ਮੈਂ ਨਾ ਬਠਿੰਡਾ ਹੁਣੇ ਸ਼ਿਫਟ ਹੋਇਆ ਤਾਂ ਮੈਂ ਇੱਕ ਤਾਂ ਮੈਨੂੰ ਤੁਸੀਂ ਇੱਥੋਂ ਦਾ ਕੁਛ ਪ੍ਰਸਿੱਧ ਚੀਜ਼ਾਂ ਦੱਸੋ ਵੀ ਜਿਹੜੀਆਂ ਬਠਿੰਡੇ 'ਚ ਫੇਮਸ ਹੈਗੀਆਂ ਜਾਂ ਕੋਈ ਅੱਛਾ ਘਰ ਵੀ ਰਿਕਮੈਂਡ ਕਰ ਦਿਓ ਵੀ ਜਿੱਥੇ ਰਹਿਣ ਨੂੰ ਵਧੀਆ ਜਗ੍ਹਾ ਹੋਵੇ ਹਾਂਜੀ ਹਾਂਜੀ ਹਾਂਜੀ ਨਹੀਂ ਨਹੀਂ ਬਸ ਉੱਥੇ ਨਾ ਸ਼ਾਂਤੀ ਹੋਵੇ ਬਸ ਵਾਹਲਾ ਸ਼ੋਰ ਸ਼ਰਾਬਾ ਨਹੀਂ ਚਾਹੀਦਾ ਭਾਵੇਂ ਪੀਸਫੁਲ ਉੱਥੇ ਫਿਰ ਰੇਟ ਜ਼ਿਆਦਾ ਹੋਏਗਾ ਨਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਜੀ ਹਾਂਜੀ ਹਾਂਜੀ ਹੂੰ ਹੂੰ ਹਾਂਜੀ ਹਾਂਜੀ ਅੱਛਾ ਅੱਛਾ ਜੀ ਹਾਂਜੀ ਹਾਂਜੀ ਸਰ ਹੂੰ ਹੂੰ ਹੂੰ ਹੂੰ ਹੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਠੀ ਠੀਕ ਹੈ ਜੀ ਹੂੰ ਹਾਂਜੀ ਸ਼ਨੀ ਐਤਵਾਰ ਛੁੱਟੀ ਹੁੰਦੀ ਹੈ ਜੀ ਹਾਂਜੀ ਅੱਛਾ ਅੱਛਾ ਚਲੋ ਹੂੰ ਹੂੰ ਠੀਕ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਓਕੇ ਓਕੇ